ਦੋ ਕੁ ਹਫ਼ਤੇ ਪਹਿਲਾਂ ਮੈਂ ਲੁਧਿਆਣੇ ਬੱਸ ਰਾਹੀਂ ਸਫ਼ਰ ਕੀਤਾ ਇਹ ਇੱਕ ਸਰਕਾਰੀ ਬੱਸ ਦਾ ਸਫ਼ਰ ਸੀ ਮੈਂ ਆਪਣੀ ਟਿਕਟ ਲੈ ਕੇ ਸੀਟ 'ਤੇ ਬੈਠ ਗਿਆ ਕਿਉਂਕਿ ਬੱਸ ਦੇ ਚੱਲਣ 'ਚ ਹਜੇ ਕਾਫ਼ੀ ਸਮੇਂ ਸੀ ਮੇਰਾ ਧਿਆਨ ਬੱਸ ਨਾਲ ਜੁੜੀ ਕੁਝ ਚੀਜ਼ਾਂ ਵੱਲ ਪਿਆ ਜਿਵੇਂ ਕਿ ਡਰਾਈਵਰ ਦੀ ਸੀਟ ਨਾਲ ਇੱਕ ਛੋਟੀ ਸੀਟ ਹੁੰਦੀ ਹੈ ਜਿੱਥੇ ਸਿਰਫ਼ ਬੱਸ ਕੰਡਕਟਰ ਹੀ ਬੈਠਦਾ ਹੈ ਫਿਰ ਮੈਂ ਦੇਖਿਆ ਕਿ ਬੱਸ ਦੀ ਵਿੰਡੋਜ਼ ਵੀ ਥੋੜ੍ਹੀ ਖਸਤਾ ਹਾਲਤ 'ਚ ਸਨ ਇਹ ਹੀ ਹਾਲ ਬੱਸ ਦੀਆਂ ਸੀਟਾਂ ਦਾ ਵੀ ਸੀ ਕੁਝ ਕੁ ਸੀਟਾਂ ਤਾਂ ਬਿਲਕੁਲ ਹੀ ਉਖੜੀਆਂ ਪਈਆਂ ਸਨ ਅਤੇ ਇਹ ਮੈਂ ਉਦੋਂ ਗੌਰ ਕੀਤਾ ਜਦੋਂ ਮੈਂ ਆਪਣੀ ਸੰ ਆਪਣੀ ਸੰਬੰਧਿਤ ਸੀਟ ਨੂੰ ਲੱਭ ਰਿਹਾ ਸੀ ਫਿਰ ਮੈਂ ਦੇਖਿਆ ਕਿ ਮੇਰੀ ਸੀਟ ਦੇ ਬਿਲਕੁਲ ਉੱਪਰ ਸਟੋਰੇਜ ਕੈਰੀਅਰ ਵੀ ਲੱਗਿਆ ਹੈ ਜਿਹਦੇ 'ਤੇ ਕਾਫ਼ੀ ਸਵਾਰੀਆਂ ਦਾ ਸਮਾਨ ਪਿਆ ਹੋਇਆ ਸੀ ਫਿਰ ਜਦੋਂ ਬੱਸ ਆਪਣੀ ਮੰਜ਼ਿਲ ਵੱਲ ਨੂੰ ਤੁਰੀ ਕੰਡਕਟਰ ਨੇ ਟਿਕਟ ਦਿੱਤੀ ਜਿਸ 'ਚ ਮੈਂ ਦੇਖਿਆ ਕਿ ਇਹ ਬੱਸ ਡੀਜ਼ਲ 'ਤੇ ਚੱਲਦੀ ਹੈ ਫਿਰ ਹੌਲੀ ਹੌਲੀ ਆਪੋ ਆਪਣੇ ਸਟੋਪ ਅਨੁਸਾਰ ਬੱਸ ਆਪਣੀ ਮੰਜ਼ਿਲ 'ਤੇ ਵਧੀ ਅਤੇ ਮੈਂ ਲੁਧਿਆਣੇ ਪਹੁੰਚਿਆ ਧੰਨਵਾਦ